ਮੈਨੂੰ ਕਦੇ ਵਕੀਲ ਅਤੇ ਪੁਲਿਸ ਦੀ ਲੋੜ ਨਹੀਂ ਪਈ ਥੋੜ੍ਹੇ ਕੁ ਚਿਰ ਪਹਿਲਾਂ ਮੈਨੂੰ ਘਰ ਦੀ ਰਜਿਸਟਰੀ ਕਰਵਾਉਣੀ ਸੀਗੀ ਇਸ ਲਈ ਮੈਨੂੰ ਤਹਿਸੀਲ ਜਾਣਾ ਪਿਆ ਪਹਿਲਾਂ ਤਾਂ ਮੈਂ ਪਟਵਾਰੀ ਕੋਲ ਪਟਵਾਰੀ ਤੋਂ ਇੰਤਕਾਲ ਲਿਆ ਉਸ ਤੋਂ ਬਾਅਦ ਫਿਰ ਮੈਂ ਤਹਿਸੀਲ 'ਚ ਗਈ ਤਹਿਸੀਲ ਜਾ ਕੇ ਮੈਂ ਸਟਾਮ ਪੇਪਰ ਲਿਆ ਸਟਾਮ ਪੇਪਰ ਲੈ ਕੇ ਤਹਿਸੀਲਦਾਰ ਤੋਂ ਸੈਨ ਕਰਵਾਏ ਫਿਰ ਪਟਵਾਰੀ ਤੋਂ ਸੈਨ ਕਰਵਾਏ ਫਿਰ ਮੈਂ ਜਾ ਕੇ ਤਹਿਸੀਲ ਗਈ ਜਾ ਕੇ ਉਹਨਾਂ ਤੋਂ ਮੈਂ ਰਜਿਸਟਰੀ ਕਰਵਾਈ ਰਜਿਸਟਰੀ ਦੇ ਮੈਨੂੰ ਉਹਨਾਂ ਨੇ ਡੇਟ ਦੇ ਤੀ ਵੀਹ ਦਿਨਾਂ ਦੀ ਅਤੇ ਇੱਕ ਮੈਨੂੰ ਕਈਆਂ ਨੇ ਕਿਹਾ ਕਿ ਤੁਸੀਂ ਦਸ ਹਜ਼ਾਰ ਰੁਪਿਆ ਦੇ ਦਿਉ ਮੈਂ ਤੁਹਾਡੀ ਰਜਿਸਟਰੀ ਦੋ ਦਿਨਾਂ 'ਚ ਕਰਵਾ ਦਊਂਗਾ ਜਦੋਂ ਕਿ ਜਿਸ ਕਰਕੇ ਮੈਨੂੰ ਕਈ ਵਾਰ ਕਈ ਮੁਸ਼ਕਿਲਾਂ ਵੀ ਆਈਆਂ ਕਦੇ ਬੁਕ ਤਹਿਸੀਲਦਾਰ ਛੁੱਟੀ 'ਤੇ ਹੁੰਦੇ ਕਦੇ ਪਟਵਾਰੀ ਦੀ ਹੜਤਾਲ ਹੁੰਦੀ ਇਸ ਲਈ ਕਈ ਵਾਰ ਸਾਨੂੰ ਲਾਇਨਾਂ 'ਚ ਵੀ ਲੱਗਣਾ ਪਿਆ ਲਾਇਨਾਂ 'ਚ ਲੱਗਣਾ ਪਿਆ ਕਈਆਂ ਨੇ ਸਾਨੂੰ ਕਿਹਾ ਤੁਸੀਂ ਪੈਸੇ ਦੇ ਦਿਉ ਮੈਂ ਕਿਹਾ ਮੈਂ ਪੈਸੇ ਨਹੀਂ ਦੇਣੇ ਮੈਂ ਵੀਹ ਦਿਨਾਂ 'ਚ ਰਜਿਸਟਰੀ ਕਰਵਾ ਲਈ ਇਸ ਲਈ ਮੈਂ ਭ੍ਰਿਸ਼ਟਾਚਾਰ ਦੇ ਸਖ਼ਤ ਖਿਲਾਫ਼ ਹਾਂ